ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਆਪਾਂ ਨੇ ਜੀ ਫੋਨ ਓਡਰ ਕੀਤਾ ਤਾ ਜੀ ਤੁਹਾਡੇ ਕੋਲ਼ ਤੁਹਾਡਾ ਫੋਨ ਮੈਨੂੰ ਮਿਲ ਗਿਆ ਏ ਜੀ ਸੈਮਸੰਗ ਦਾ ਓਡਰ ਕੀਤਾ ਤਾ ਜੀ ਫੋਨ ਵਧੀਆ ਚੱਲਿਆ ਜੀ ਫੋਨ ਹਾਂਜੀ ਫੋਨ ਦਾ ਮਤਲਬ ਸੋਹਣੀ ਹੈ ਜੀ ਚਾਰ ਚੋਂਹਟ ਆ ਜੀ ਉਹਦੇ ਵਿੱਚ ਫੇਸਬੁੱਕ ਹੋਰ ਐਪ ਜੀ ਸਾਰੇ ਵਧੀਆ ਚੱਲਦੇ ਆ ਜੀ ਫੋਨ ਦੀ ਮਤਲਬ ਰੀਕਵਰੀ ਵਧੀਆ ਹੈ ਜੀ ਹੈਂਗ ਨਹੀਂ ਹੁੰਦਾ ਹੈਗਾ ਹੋਰ ਫੋਨ ਵਿੱਚ ਯੂਟਿਊਬ ਇੰਸਟਾਗ੍ਰਾਮ ਫੇਸਬੁੱਕ ਜੀ ਮਤਲਬ ਸਾਰਾ ਕੁਝ ਗੇਮਾਂ ਗੁੰਮਾਂ ਵਧੀਆ ਚੱਲਦੀਆਂ ਏ ਜੀ ਹੋਰ ਯੂਟਿਉਬ ਬਹੁਤ ਵਧੀਆ ਚੱਲਦੀ ਯੂਟਿਊਬ ਵਿੱਚ ਜਿਵੇਂ ਇੰਗਲਿਸ਼ ਸਿੱਖਣ ਨੂੰ ਜੀ ਪੰਜਾਬੀ ਹੋਰ ਕਈ ਭਾਸ਼ਾਵਾਂ ਜੋ ਵੀ ਸਿੱਖਣ ਨੂੰ ਹੈ ਜੀ ਇਹਦੇ ਵਿੱਚ ਵਧੀਆ ਚੱਲਦਾ ਸਾਰਾ ਕੁਝ ਫੋਨ ਇੱਕ ਇੱਕ ਨੰਬਰ ਚੱਲ ਰਿਹਾ ਜੀ ਨਾ ਤਾਂ ਇਹ ਹੈਂਗ ਹੁੰਦਾ ਨਾ ਕੁਛ ਇਹਨੂੰ ਖਰਾਬੀ ਹੈ ਨਾ ਕੋਈ ਉਹ ਹੈ ਤੁਹਾਡੀ ਡਿਲੀਵਰੀ ਵੀ ਠੀਕ ਹੈ ਜੀ ਟਾਈਮ ਨਾਲ਼ ਮਿਲ ਗਿਆ ਜੀ ਮੈਨੂੰ ਫੋਨ ਹਾਂਜੀ ਫੋਨ ਤੁਹਾਡਾ ਡਿਲੀਵਰੀਬੁਆਏ ਵੀ ਠੀਕ ਹੈ ਅਤੇ ਨਾਲ਼ੇ ਫੋਨ ਵਿੱਚ ਹੋਰ ਵੀ ਆਈਟਮਾਂ ਏ ਜੀ ਜਿਹੜੀਆਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਜੀ ਸੈਮਸੰਗ ਦਾ ਵਧੀਆ ਕੌਂਪਣੀ ਦਾ ਫੋਨ ਹੈ ਜੀ ਅਤੇ ਵਧੀਆ ਚੱਲ ਰਿਹਾ ਏ ਅਤੇ ਵਧੀਆ ਉਹ ਹੈ ਚਲੋ ਠੀਕ ਹੈ ਭਾਅ ਜੀ ਓਕੇ